ਮੈਂ ਆਪਣੀ ਸਹੇਲੀ ਲਈ ਇੱਕ ਗਦਕਾਵਿ ਲਿਖਿਆ ਹੈ ਜਿਸ ਦਾ ਨਾਮ ਹੈ ਜ਼ਿੰਦਗੀ ਦੀ ਇਬਾਰਤ ਜ਼ਿੰਦਗੀ ਦੀਆਂ ਗੱਲਾਂ ਬਾਰੇ ਇਸ ਪੁਸਤਕ ਦੇ ਵਿੱਚ ਬਹੁਤ ਕੁਛ ਦਰਜ ਹੈ ਅਤੇ ਮੇਰੀ ਸਹੇਲੀ ਨੂੰ ਇਹ ਬਹੁਤ ਪਸੰਦ ਆਇਆ ਕਿਉਂਕਿ ਮੈਂ ਉਹਦੇ ਨਾਲ ਬਹੁਤ ਸਮਾਂ ਬਤੀਤ ਕਰਦੀ ਹਾਂ ਅਤੇ ਜੋ ਅਸੀਂ ਉੱਨ ਉਸ ਸਮੇਂ ਦੇ ਵਿੱਚ ਆਪਸ ਦੇ ਵਿੱਚ ਗੱਲਾਂ ਕਰਦੇ ਹਾਂ ਜਾਂ ਕੋਈ ਕੰਮ ਕਾਰ ਕਰਦੇ ਹਾਂ ਉਸ ਤਰ੍ਹਾਂ ਦੇ ਬਹੁਤ ਸਾਰੇ ਤਜ਼ਰਬੇ ਮੈਂ ਇਸ ਕਿਤਾਬ ਦੇ ਰਾਹੀਂ ਸਾਂਝੇ ਕੀਤੇ ਹਨ ਅਤੇ ਮੇਰੀ ਸਹੇਲੀ ਨੂੰ ਇਹ ਕਿਤਾਬ ਇਸ ਕਰਕੇ ਪਸੰਦ ਆਈ ਕਿਉਂਕਿ ਉਸ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੀਆਂ ਗੱਲਾਂ ਮੈਂ ਉਸ ਪੁਸਤਕ ਦੇ ਵਿੱਚ ਦਰਜ ਕਰ ਦਿੱਤੀਆਂ ਹਨ ਜੇ ਜੋ ਜਿਹੜੀ ਕਿ ਹਮੇਸ਼ਾ ਹੀ ਲਿਖੀਆਂ ਗਈਆਂ ਅਤੇ ਹਮੇਸ਼ਾ ਲਈ ਕਲਮਬੱਧ ਕਰਕੇ ਉਨ੍ਹਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੁਰੱਖਿਅਤ ਕਰ ਦਿੱਤਾ ਗਿਆ ਅਤੇ ਕਦੇ ਵੀ ਉਹ ਪੁਸਤਕ ਦੇ ਵਿੱ ਰਾਹੀਂ ਇਹਨਾਂ ਨੂੰ ਪੜ੍ਹ ਸਕਦੀ ਹੈ ਅਤੇ ਯਾਦ ਕਰ ਸਕਦੀ ਹੈ ਖੁਸ਼ਗਵਾਰ ਪਲਾਂ ਨੂੰ ਦੁਬਾਰਾ ਜਿਹੜਾ ਹੈਗਾ ਆਪਣੇ ਮਨ ਦੇ ਵਿੱਚ ਉਨ੍ਹਾਂ ਨੂੰ ਇੱਕ ਰੀਮੈਂਬਰ ਕਰ ਸਕਦੀ ਹੈ ਚੰਗੀ ਤਰ੍ਹਾਂ ਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਹੁਸੀਨ ਪਲਾਂ ਦਾ ਅ ਆਨੰਦ ਹੈ ਜਿਹੜਾ ਉਹ ਦੁਬਾਰਾ ਵੀ ਲੈ ਸਕਦੀ ਹੈ ਉਹਨੂੰ ਪੜ੍ਹਨ ਤੋਂ ਬਾਅਦ ਉਹਨੂੰ ਬਹੁਤ ਵਧੀਆ ਲੱਗਿਆ